ਹਾਂਜੀ ਸਤਿ ਸ਼੍ਰੀ ਅਕਾਲ ਜੀ ਮਲਚ ਦੀ ਵਰਤੋਂ ਕਿਵੇਂ ਕਰਦੇ ਹੋ ਇਸਦੇ ਕੀ ਫਾਇਦੇ ਹਨ ਹਾਂਜੀ ਇਸ ਦਾ ਪਹਿਲਾ ਫਾਇਦਾ ਵਾਤਾਵਰਨ ਪ੍ਰਦੂਸ਼ਣ ਦੀ ਰੋਕਥਾਮ ਪਰਾਲੀ ਨੂੰ ਮਲਚ ਵਜੋਂ ਅਰਨਨ ਨਾਲ ਪਰਾਲੀ ਸਾੜਨ ਦੀ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ ਮਿੱਟੀ ਵਿੱਚ ਮੌਜੂਦਾ ਭਾਰੀ ਤੱਤਾਂ ਨੂੰ ਕੱਢਣਾ ਮਿੱਟੀ ਵਿੱਚੋਂ ਇਨ੍ਹਾਂ ਭਾਰੀ ਤੱਤਾਂ ਨੂੰ ਕੱਢਣ ਲਈ ਜੈਵਿਕ ਮਲਚ ਇੱਕ ਵਧੀਆ ਸਰੋਤ ਹੈ ਮਲਚ ਵਿਧੀ ਦੀਆਂ ਸਿਫ਼ਾਰਿਸ਼ਾਂ ਦੀ ਸੰਭਾਲ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸਿਧਾਂਤਾਂ ਮਲਚ ਦੀਆਂ ਕਿਸਮਾਂ ਆਮ ਤੌਰ 'ਤੇ ਮਲਚ ਸਮੱਗਰੀ ਦੋ ਤਰ੍ਹਾਂ ਦੀ ਹੁੰਦੀ ਹੈ ਜੈਵਿਕ ਮਲਚ ਅਜੈਵਿਕ ਮਲਚ ਜੈਵਿਕ ਮਲਚ ਇਹ ਮਲਚ ਪਦਾਰਥ ਪੌਦਿਆਂ ਅਤੇ ਜਾਨਵਰਾਂ ਦੇ ਮੂਲ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਅਜੈਵਿਕ ਮਲਚ ਇਸ ਵਿੱਚ ਆਮ ਤੌਰ 'ਤੇ ਪਲਾਸਟਿਕ ਦੀਆਂ ਸੀਟਾਂ ਫਿਲਮਾਂ ਆਦਿ ਨੂੰ ਖੇਤੀ ਸਬਜ਼ੀਆਂ ਆਦਿ ਫ਼ਸਲਾਂ ਵਿੱਚ ਵਰਤਿਆ ਜਾ ਸਕਦਾ ਹੈ ਹਾਂਜੀ ਮਲਚ ਦੇ ਸਾਨੂੰ ਬਹੁਤ ਸਾਰੇ ਫਾਇਦੇ ਹਨ ਅਸੀਂ ਇਸ ਦੀ ਵਰਤੋਂ ਤੋਂ ਕਰਦੇ ਸਮੇਂ ਸਾਨੂੰ ਇਸਦੀ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ